ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿੰਦਰ ਪਾਲ ਗੱਲ ਕਰ ਰਿਹਾ ਹਾਂ ਅਤੇ ਮੈਂ ਪਿਛਲੇ ਔਡਰ ਕੀਤਾ ਸੀ ਹਜ਼ਾਰ ਰੁਪਏ ਦਾ ਉਹਦੇ ਵਿੱਚ ਮੈਨੂੰ ਵੀਹ ਪ੍ਰਤ ਪ੍ਰਤੀਸ਼ਤ ਦਾ ਡਿਸਕਾਊਂਟ ਕੂਪਨ ਪ੍ਰਾਪਤ ਹੋਇਆ ਸੀ ਅਤੇ ਉਸ ਕੂਪਨ ਵਰਤੋਂ ਕਰਕੇ ਹੁਣ ਮੈਂ ਆਪਣਾ ਨਵਾਂ ਔਡਰ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਸ਼ਾਹੀ ਪਨੀਰ ਦਾਲ ਮੱਖਣੀ ਅਤੇ ਬਟਰ ਨਾਨ ਦਾ ਔਡਰ ਹੈ ਅਤੇ ਇਸ ਔਡਰ ਨੂੰ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪਿਛਲਾ ਜਿਹੜਾ ਵੀਹ ਪ੍ਰਸੈਂਟ ਹੈ ਉਸ ਨੂੰ ਇਸ ਵਿੱਚ ਜੋੜ ਕੇ ਬਣਦਾ ਬਿਲ ਕੈਸ਼ ਔਨ ਡਿਲੀਵਰੀ ਰਾਹੀਂ ਮੈਂ ਪੇ ਕਰਨਾ ਚਾਹੁੰਦਾ ਹਾਂ ਤੋ ਇਸ ਔਡਰ ਨੂੰ ਜਲਦੀ ਤੋਂ ਜਲਦੀ ਭੇਜਣ ਦੀ ਖੇਚਲ ਕਰਨਾ ਧੰਨਵਾਦ